ਪੰਜਾਬ ਦੀ ਸੰਸਕ੍ਰਿਤੀ ਹਸਤ ਕਲਾ ਅਤੇ ਸ਼ਿਲਪਕਾਰੀ ਨਾਲ ਭਰਪੂਰ ਹੈ ਜੋ ਸਦੀਆਂ ਤੋਂ ਲੋਕ ਜੀਵਨ ਅਤੇ ਵਿਰਾਸਤ ਦਾ ਹਿੱਸਾ ਰਹੀਆਂ ਹਨ ਇਹ ਸ਼ਿਲਪਕਾਰ ਲਵਾਂ ਨਿਰਮਾਤਾਵਾਂ ਦੀ ਰਚਨਾਤਮਕਤਾ ਅਤੇ ਮਿਹਨਤ ਨੂੰ ਦਰਸਾਉਂਦੀਆਂ ਹਨ ਫੁਲਕਾਰੀ ਪੰਜਾਬ ਦੀ ਇੱਕ ਪ੍ਰਸਿੱਧ ਕੱਪੜਾ ਕਢਾਈ ਕਲਾ ਹੈ ਜਿਸ ਵਿੱਚ ਰੰਗ ਬਿਰੰਗੇ ਧਾਗਿਆਂ ਨਾਲ ਹੱਥਾਂ ਦੀ ਕਢਾਈ ਕੀਤੀ ਜਾਂਦੀ ਹੈ ਇਹ ਵਿਲੱਖਣ ਡਿਜ਼ਾਇਨ ਤਿਉਹਾਰਾਂ ਵਿਆਹ ਸ਼ਾਦੀਆਂ ਅਤੇ ਵਿਸ਼ੇਸ਼ ਮੌਕਿਆਂ ਉੱਤੇ ਵਰਤੀ ਜਾਂਦੀ ਹੈ ਜਲੰਧਰ ਪੰਜਾਬ ਦਾ ਇੱਕ ਪ੍ਰਾਚੀਨ ਸ਼ਹਿਰ ਹੈ ਜੋ ਆਪਣੀ ਸੰਸਕ੍ਰਿਤਿਕ ਵਿਰਾਸਤ ਅਤੇ ਸ਼ਿਲਪਕਲਾ ਲਈ ਜਾਣਿਆ ਜਾਂਦਾ ਹੈ ਇੱਥੇ ਕਈ ਪ੍ਰਸਿੱਧ ਹਸਤ ਕਲਾਵਾਂ ਹਨ ਜੋ ਲੋਕ ਜੀਵਨ ਇਤਿਹਾਸ ਅਤੇ ਵਿਰਾਸਤ ਨਾਲ ਗਹਿਰੀ ਤੌਰ 'ਤੇ ਜੁੜਿਆ ਹੋਇਆ ਹਨ ਫੁਲਕਾਰੀ ਜਲੰਧਰ ਵਿੱਚ ਕਾਫ਼ੀ ਪ੍ਰਸਿੱਧ ਹੈ ਇਹ ਹੱਥੀਂ ਕੀਤੀ ਜਾਣ ਵਾਲੀ ਕਢਾਈ ਹੈ ਜੋ ਜ਼ਿਆਦਾਤਰ ਰੰਗ ਬਰੰਗੇ ਧਾਗਿਆਂ ਨਾਲ ਕੰਬਲ ਦੁਪੱਟੇ ਅਤੇ ਕੱਪੜਿਆਂ 'ਤੇ ਬਣਾਈ ਜਾਂਦੀ ਹੈ ਇਹ ਵਿਲੱਖਣ ਕਲਾ ਪੰਜਾਬੀ ਵਿਆਹਾਂ ਤਿਉਹਾਰਾਂ ਅਤੇ ਵਿਸ਼ੇਸ਼ ਮੌਕਿਆਂ ਉੱਤੇ ਵਰਤੀ ਜਾਂਦੀ ਹੈ ਪੀੜ੍ਹੀਆਂ ਅਤੇ ਲੱਕੜ ਦੀ ਕਲਾ ਵੀ ਇੱਥੇ ਕਾਫ਼ੀ ਲੋਕਪ੍ਰਿਯ ਹੋਇਆ ਜਲੰਧਰ ਵਿੱਚ ਤਿਆਰ ਕੀਤੀਆਂ ਪੀੜ੍ਹੀਆਂ ਚੋਂਕੀਆਂ ਅਤੇ ਹੋਰ ਲੱਕੜੀ ਦੇ ਸਾਜ ਸਮਾਨ ਪੰਜਾਬ ਦੇ ਘਰਾਂ ਵਿੱਚ ਆਮ ਤੌਰ 'ਤੇ ਵਰਤੇ ਜਾਂਦੇ ਹਨ ਇਹ ਹਸਤ ਕਲਾ ਦਸਤਕਾਰੀ ਹੁਨਰ ਦੀ ਨਿਸ਼ਾਨੀ ਹੈ ਟੋਕਰੀ ਬਣਾਈ ਜਲੰਧਰ ਅਤੇ ਇੱਥੇ ਨੇੜਲੇ ਪਿੰਡਾਂ ਵਿੱਚ ਮਹੱਤਵਪੂਰਨ ਹੈ ਬਾਂਸ ਅਤੇ ਤਾਰ ਦੀ ਵਰਤੋਂ ਕਰਕੇ ਤਿਆਰ ਕੀਤੀਆਂ ਟੋਕਰੀਆਂ ਚਟਾਈਆਂ